ਕੁਝ ਵਹਿਮਾਂ ਭਰਮਾਂ ਬਾਰੇ ਦੱਸੋ ਜਿਹਨਾਂ ਦੇ ਤੁਸੀਂ ਜਾਂ ਤੁਹਾਡੇ ਇਲਾਕੇ ਲੋਕ ਮਜਬੂਤੀ ਨਾਮ ਵਿਸ਼ਵਾਸ਼ ਕਰਦੇ ਹਨ ਸਾਡੇ ਇਲਾਕੇ ਦੇ ਬਹੁਤ ਲੋਕ ਵਹਿਮਾਂ ਭਰਮਾਂ 'ਤੇ ਯਕੀਨ ਕਰਦੇ ਹਨ ਜਿਸ ਤਰ੍ਹਾਂ ਕਿਸੇ ਦੇ ਘਰ ਬੱਚਾ ਨਾ ਹੋਵੇ ਤਾਂ ਉਸਦੇ ਘਰ ਆਪਣੇ ਬੱਚੇ ਨੂੰ ਨਹੀਂ ਭੇਜਦੇ ਸਿਰ ਨਵਾ ਕੇ ਬੱਚੇ ਨਹੀਂ ਭੇਜਦੇ ਕਿ ਉਹਦਾ ਵਾਲ ਕੱਟ ਲੇਗੀ ਜਾਦੂ ਟੂਣਾ ਕਰ ਦੇਗੀ ਉਹ ਮਾਂ ਜਿਹਦੇ ਘਰ ਬੱਚਾ ਨਹੀਂ ਹੈਗਾ ਬਿੱਲੀ ਰਾਹ ਕੱਟ ਜਾਵੇ ਤਾਂ ਫਿਰ ਉਹਤੋਂ ਵੀ ਅਪਸ਼ਗਨ ਮੰਨਦੇ ਆ ਫਿਰ ਵਾਪਸ ਜਾਓ ਦੋ ਕਦਮ ਫਿਰ ਦੁਬਾਰਾ ਆਓ ਨਹੀਂ ਤਾਂ ਕੰਮ ਨਹੀਂ ਹੋਵੇਗਾ ਜਿਹਨਾਂ ਦੇ ਵਿਆਹ ਨਹੀਂ ਹੁੰਦੇ ਉਹ ਚੋਰਾਹਿਆਂ ਦੇ ਉੱਤੇ ਝਾੜੂ ਖਿਲਾਰ ਦਿੰਦੇ ਆ ਨਾਰੀਅਲ ਚੜਾ ਦਿੰਦੇ ਆ ਨਹਿਰਾਂ ਵਿੱਚ ਨਾਰੀਅਲ ਸੁੱਟਦੇ ਆ ਕਿ ਸਾਡਾ ਵਿਆਹ ਹੋ ਜਾਵੇ ਪਰ ਉਹ ਉਹਨਾਂ ਲੋਕਾਂ 'ਤੇ ਬਿਲਕੁਲ ਅਸਰ ਨਹੀਂ ਕਰਦਾ ਜਿਹੜੇ ਨਹਿਰਾਂ ਦੇ ਵਿੱਚ ਗਰੀਬ ਬੱਚੇ ਜੰਪ ਛਾਲ ਮਾਰ ਕੇ ਉਸੇ ਟਾਈਮ ਨਾਰੀਅਲ ਕੱਢ ਕੇ ਖਾ ਲੈਂਦੇ ਆ ਜਾਂ ਵੇਚ ਦਿੰਦੇ ਆ ਉਹ ਆਪਣਾ ਗੁਜ਼ਾਰਾ ਚਲਾ ਲੈਂਦੇ ਆ ਅਤੇ ਦੋ ਬੱਚਿਆਂ ਦਾ ਸਿਰ ਵੱਜ ਜਾਵੇ ਆਪਸ ਤਾਂ ਕਹਿੰਦੇ ਆ ਵੀ ਇੱਕ ਵਾਰੀ ਫਿਰ ਮਾਰੋ ਨਹੀਂ ਤਾਂ ਸਿੰਗ ਉੱ ਉੱਗ ਜਾਣਗੇ ਜੁੱਤੀ ਪੁੱਠੀ ਹੋ ਜਾਵੇ ਤਾਂ ਕਹਿਣਗੇ ਅਪਸ਼ਗਨ ਹੋ ਗਿਆ ਜੁੱਤੀ ਸਿੱਧੀ ਕਰੋ